ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬੀਆਂ ਦੀ ਸਭ ਤੋਂ ਵਧੀਆ ਖੂਬੀ ਆਓ ਭਗਤ ਹੀ ਮੰਨੀ ਗਈ ਹੈ ਕਿ ਉਹ ਆਪਣੇ ਮਹਿਮਾਨਾਂ ਨਾਲ ਬਹੁਤ ਵਧੀਆ ਪੇਸ਼ ਆਉਂਦੇ ਹਨ ਅਤੇ ਉਹਨਾਂ ਦੀ ਹਰ ਇੱਕ ਜ਼ਰੂਰਤ ਨੂੰ ਮੁੱਖ ਰੱਖਦੇ ਹਨ ਅਤੇ ਉਹਨਾਂ ਨੂੰ ਪੂਰਾ ਵੀ ਕਰਦੇ ਹਨ ਉਸ ਤਰ੍ਹਾਂ ਅਸੀਂ ਵੀ ਆਪਣੇ ਮਹਿਮਾਨਾਂ ਨੂੰ ਬਹੁਤ ਵਧੀਆ ਸਤਿਕਾਰ ਨਾਲ ਬੁਲਾਉਂਦੇ ਹਾਂ ਪਹਿਲਾਂ ਉਹਨਾਂ ਨੂੰ ਸਾਰਾ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ ਫਿਰ ਉਹਨਾਂ ਨੂੰ ਪਾਣੀ ਵਗੈਰਾ ਦਿੰਦੇ ਹਾਂ ਅਤੇ ਜੋ ਉਹਨਾਂ ਦੇ ਮਨਪਸੰਦ ਦੀਆਂ ਚੀਜ਼ਾਂ ਹੁੰਦੀਆਂ ਹਨ ਜਿਵੇਂ ਅੱਜ ਕੱਲ੍ਹ ਚਰਚਾ ਵਿੱਚ ਹਨ ਸਮੋਸਾ ਕੁਲਚਾ ਅਤੇ ਹੁੰਦੇ ਹਨ ਅਸੀਂ ਉਹਨਾਂ ਨੂੰ ਸਾਰਾ ਕੁਝ ਲਿਆ ਕੇ ਦਿੰਦੇ ਹਾਂ ਅਤੇ ਸਾਨੂੰ ਐਵੇਂ ਹੁੰਦਾ ਹੈ ਕਿ ਉਹ ਸਾਡੇ ਤੋਂ ਬਿਲਕੁਲ ਖਫ਼ਾ ਹੋ ਕੇ ਨਾ ਜਾਣ ਉਹਨਾਂ ਨੂੰ ਬਹੁਤ ਵਧੀਆ ਲੱਗੇ ਅਸੀਂ ਐਵੇਂ ਹੀ ਚਾਹੁੰਦੇ ਹੁੰਦੇ ਹਾਂ ਅਤੇ ਜਦੋਂ ਗਰਮੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਲਈ ਠੰਡਾ ਲਿਆ ਕੇ ਰੱਖਦੇ ਹਾਂ ਸਰਦੀਆਂ ਦੇ ਵਿੱਚ ਆਮ ਤੌਰ 'ਤੇ ਅਸੀਂ ਚਾਹ ਰੱਖਦੇ ਹਾਂ ਤਾਂ ਜੋ ਉਹਨਾਂ ਨੂੰ ਵੀ ਵਧੀਆ ਲੱਗੇ ਗਰਮੀਆਂ ਦੇ ਵਿੱਚ ਜ਼ਿਆਦਾ ਗਰਮੀ ਕਰਕੇ ਆਪਾਂ ਨੂੰ ਠੰਡਾ ਪੀਣ ਨੂੰ ਜੀ ਕਰਦਾ ਹੁੰਦਾ ਹੈ ਇਸ ਲਈ ਅਸੀਂ ਆਪਣੇ ਰਿਸ਼ਤੇਦਾਰਾਂ ਦੀ ਆਓ ਭਗਤ ਵਿੱਚ ਕੋਈ ਕਮੀ ਨਹੀਂ ਛੱਡਦੇ